ਹੈਲੋ ਹਾਂਜੀ ਹਾਂਜੀ ਉੱਥੋਂ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੀ ਕੀ ਪ੍ਰੋਬਲਮ ਆ ਰਹੀ ਹੈ ਮਤਲਬ ਕੋਈ ਇੱਦਾਂ ਦੀ ਪ੍ਰੋਬਲਮ ਹੈ ਵੀ ਤਾਂ ਲੜਕੀਆਂ ਨੂੰ ਜਾਂ ਵੋਮੇਨਸ ਨੂੰ ਅੱਗੇ ਨਹੀਂ ਆਉਣ ਦਿੰਦੇ ਕਿਸੇ ਵੀ ਵਰਕ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਹੈ ਮੈਂ ਜਿੱਦਾਂ ਛੋਟੇ ਮਤਲਬ ਆਪਾਂ ਲੜਕੀਆਂ ਲਈ ਹੈਲਪ ਕਰਦੇ ਹਾਂ ਮੈਰਿਜ ਲਈ ਜਾਂ ਕੁਛ ਵੀ ਕਿਸ ਤਰ੍ਹਾਂ ਦੀ ਹੈਲਪ ਚਾਹੀਦੀ ਤੁਹਾਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਮੈਨੂੰ ਆਪਣੇ ਵਿਲੇਜ ਦਾ ਨਾਮ ਦੱਸ ਦਿਉ ਤੁਸੀਂ ਆਪਣਾ ਨਾਮ ਵੀ ਦੱਸ ਦਿਉ ਮੈਨੂੰ ਅਤੇ ਫਿਰ ਅਸੀਂ ਐਨ ਜੀ ਓ ਪਰਸਨ ਸਾਰੇ ਤੁਹਾਡੇ ਕੋਲ ਆ ਕੇ ਅਸੀਂ ਥੋੜ੍ਹਾ ਜਿਹਾ ਜਾਂਚ ਪੜਤਾਲ ਕਰ ਲਵਾਂਗੇ ਵੀ ਕਿਸ ਚੀਜ਼ਾਂ ਦੀ ਤੁਹਾਨੂੰ ਨੀਡ ਹੈ ਅਤੇ ਫਿਰ ਅਸੀਂ ਉਹ ਚੀਜ਼ਾਂ ਪ੍ਰੋਵਾਈਡ ਕਰ ਸਕਾਂਗੇ ਤੁਹਾਨੂੰ ਹਰੇਕ ਹੈਲਪ ਕਰੀਏ ਤਾਂ ਕਿ ਤੁਹਾਡੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੀ ਗੱਲ ਤੋਂ ਮੈਂ ਐਗਰੀ ਹਾਂ ਬਸ ਤੁਸੀਂ ਮੈਨੂੰ ਆਪਣਾ ਐਡਰੈਸ ਵਗੈਰਾ ਸਾਰਾ ਕੁਝ ਤੁਸੀਂ ਮੈਨੂੰ ਭੇਜ ਦੇਣਾ ਅਤੇ ਅਸੀਂ ਉੱਥੇ ਵਿਜਿਟ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਜੋ ਕੁਝ ਵੀ ਸਾਡੇ ਤੋਂ ਹੈਲਪ ਹੋਈ ਐਨ ਜੀ ਓ ਪਰਸਨਸ ਤੋਂ ਜਿੰਨੀ ਵੀ ਹੈਲਪ ਹੋਈ ਅਸੀਂ ਉਹ ਹੈਲਪ ਕਰਾਂਗੇ ਤੁਹਾਡੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਜ਼ਰੂਰ ਕਰਾਂਗੇ ਜਿੰਨੀ ਸਾਡੀ ਹੈਲਪ ਹੋਈ ਅਸੀਂ ਜ਼ਰੂਰ ਕਰਾਂਗੇ ਪਰ ਤੁਸੀਂ ਆਪਣਾ ਸਾਰਾ ਕੁਝ ਹੈ ਨਾ ਮੈਨੂੰ ਦੱਸ ਦੇਣਾ ਅਗਰ ਜਿਹੜੇ ਪਰਸਨਸ ਨੂੰ ਵੀ ਜਿਨ੍ਹਾਂ ਨੂੰ ਵੀ ਨੀਡ ਹੈ ਅਗਰ ਹੋਰ ਪਰਸਨ ਹੈਗੇ ਹੈ ਤੁਹਾਡੇ ਨੋਨ ਦੇ ਵਿੱਚ ਜਾਂ ਕਿਤੇ ਵੀ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਸਾਡੀ ਐਨ ਜੀ ਓ ਅੱਜ ਹੋਰ ਵੀ ਬਥੇਰੇ ਕੰਮਾਂ 'ਚ ਹੈਲਪ ਕਰਦੀ ਹੈ ਅਸੀਂ ਬਹੁਤ ਕੀਤਾ ਕੰਮ ਹਾਂਜੀ ਅੱਗੇ ਵੀ ਬਥੇਰੇ ਪਰਸਨਸ ਨੂੰ ਹਾਂਜੀ ਹਾਂਜੀ ਹਾਂਜੀ ਬਸ ਤੁਸੀਂ ਅਸੀਂ ਜਲਦੀ ਵਿਜਿਟ ਕਰਾਂਗੇ ਅਤੇ ਸਰੇਸ਼ ਵਾਲਾ ਪਿੰਡ ਹੈ ਨਾ ਤੁਹਾਡਾ ਹਾਂਜੀ ਚਲੋ ਫਿਰ ਤੁਹਾਨੂੰ ਕੌਲ ਕਰਾਂਗੇ ਜਦੋਂ ਅਸੀਂ ਵਿਜਿਟ ਕਰਾਂਗੇ ਤਾਂ ਅਸੀਂ ਹੈਲਪ ਜਿੰਨੀ ਹੋਈ ਅਸੀਂ ਓਨੀ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੈਲਕਮ ਬਾਏ